ਓਲਾ ਮਦਦ ਕੇਂਦਰ ਹਾਂਜੀ ਮੈਂ ਤੁਹਾਨੂੰ ਹਾਲ ਹੀ ਦੇ ਵਿੱਚ ਕਰੀ ਹੋਈ ਰਾਈਡ ਬੁੱਕ ਦੇ ਬਾਰੇ ਸ਼ਿਕਾਇਤ ਕਰਨ ਦੇ ਲਈ ਫੋਨ ਕਰਿਆ ਹੈ ਮੈਂ ਹਾਲ ਦੇ ਵਿੱਚ ਆਪਣੀ ਚੰਡੀਗੜ੍ਹ ਦੇ ਬੱਤੀ ਸੈਕਟਰ ਤੋਂ ਨਆਂ ਗਾਓਂ ਦੀ ਰਾਈਡ ਬੁੱਕ ਕਰੀ ਸੀ ਜਿਸ ਜਿਸ ਦੇ ਵਿੱਚ ਮੈਨੂੰ ਚਾ ਅ ਚਾਲਕ ਦੀ ਵਾਹਨ ਚਾਲਕ ਦਾ ਸਮਾਂ ਦਿਖਾ ਰਿਹਾ ਸੀ ਦਸ ਮਿੰਟ ਪਰ ਹੁਣ ਮੈਨੂੰ ਉਰੇ ਖੜ੍ਹੇ ਹੋਏ ਵੀਹ ਮਿੰਟ ਹੋ ਗਏ ਹਨ ਅਤੇ ਉਹ ਚਾਲਕ ਹਜੇ ਤੱਕ ਨਹੀਂ ਆਇਆ ਹੈ ਇੰਨੀ ਗਰਮੀ ਦੇ ਵਿੱਚ ਮੈਨੂੰ ਇੱਥੇ ਖੜ੍ਹੇ ਹੋਣਾ ਬਹੁਤ ਮੁਸ਼ਕਿਲ ਹੋ ਹੋ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਵੀ ਤੁਸੀਂ ਮੇਰੀ ਇਹ ਰਾ ਇਹ ਰਾਈਡ ਇਹ ਰੱਦ ਕਰ ਦਿਓ ਮੈਂ ਖੁਦ ਤੋਂ ਰੱਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਉਹ ਰੱਦ ਨਹੀਂ ਹੋ ਪਾ ਰਹੀ ਹੈ ਅਤੇ ਇਹ ਰਾਈਡ ਰੱਦ ਕਰੇ ਬਿਨਾਂ ਮੈਂ ਦੂਸਰੀ ਰਾਈਡ ਨਹੀਂ ਬੁੱਕ ਕਰ ਪਾਵਾਂਗਾ ਅਤੇ ਸਮੇਂ ਸਿਰ ਆਪਣੇ ਸਥਾਨ 'ਤੇ ਨਹੀਂ ਪਹੁੰਚ ਪਾਵਾਂਗਾ ਮੇਰਾ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਅਤੇ ਜਿਹੜਾ ਵਾਹਨ ਚਾਲਕ ਹੈ ਉਸ ਨੂੰ ਵੀ ਮੈਂ ਵਾਰ ਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਹਿਲਾਂ ਤਾਂ ਉਹਦਾ ਨੰਬਰ ਹੀ ਗਲਤ ਨਹੀਂ ਲੱਗ ਪਾ ਰਿਹਾ ਸੀ ਪਰ ਹੁਣ ਮੇਰੀ ਉਹਦੀ ਗੱਲ ਹੋਈ ਤਾਂ ਉਹ ਮੈਨੂੰ ਵਾਰ ਵਾਰ ਅਲੱਗ ਅਲੱਗ ਬਹਾਨੇ ਦੇ ਰਿਹਾ ਹੈ ਕਿ ਕਿਸੇ ਵਕਤ ਉਹ ਕਹਿ ਰਿਹਾ ਹੈ ਕਿ ਵੀ ਉਹ ਬਸ ਪਿਛਲੀਆਂ ਲਾਈਟਾਂ 'ਤੇ ਹੈ ਪਿਛਲੀਆਂ ਲਾਈਟ 'ਤੇ ਹੈ ਪਰ ਲੈਟ ਪਾਰ ਕਰੇ ਹੋਏ ਨੂੰ ਵੀ ਦਸ ਮਿੰਟ ਹੋ ਚੁੱਕੇ ਦਸ ਮਿੰਟ ਤੋਂ ਵੱਧ ਹੋ ਚੁੱਕਾ ਹੈ ਅਤੇ ਉਹ ਹਜੇ ਤੱਕ ਮੇਰੇ ਤੱਕ ਨਹੀਂ ਪਹੁੰਚਿਆ ਹੈ ਤਾਂ ਮੇਰਾ ਤੁਹਾਨੂੰ ਇਹ ਹੀ ਮੰਗ ਹੈ ਕਿ ਤੁਸੀਂ ਜਲਦ ਤੋਂ ਜਲਦ ਮੇਰੀ ਇਹ ਜਿਹੜੀ ਸ਼ਿਕਾਇਤ ਹੈ ਇਹਨੂੰ ਦਰਜ ਕਰੋ ਅਤੇ ਮੈਨੂੰ ਕੋਈ ਸੁਝਾਓ ਦਿਓ ਮੈਨੂੰ ਕੋਈ ਸਲਿਊਸ਼ਨ ਦਿਓ ਇਸ ਨੂੰ ਰੱਦ ਕਰਨ ਦਾ